ਮੈਂ ਕਈ ਇਲੈਕਟਰੋਨਿਕ ਪ੍ਰੋਡਕਟ ਇਲੈਕਟਰੋਨਿਕ ਘੜੀ ਆਡਰ ਕੀਤੀ ਸੀ ਅਤੇ ਜੋ ਮੈਨੂੰ ਜਦੋਂ ਮੈਨੂੰ ਉਹ ਪ੍ਰਾਪਤ ਹੋਈ ਨਾ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੈਂ ਕੀ ਆਡਰ ਕਰ 'ਤਾ ਪਤਾ ਨਹੀਂ ਮੈਂ ਆਪਣੀ ਪੈਸੇ ਵੇਸਟ ਕਰ 'ਤੇ ਪਰ ਜਦੋਂ ਮੈਂ ਉਸਨੂੰ ਯੂਜ ਕੀਤਾ ਮੈਨੂੰ ਉਹਦੇ ਬੈਨੀਫਿਟਸ ਬੜੇ ਅੱਛੇ ਲੱਗੇ ਉਹਦੇ ਲਾਭ ਬਹੁਤ ਸਾਰੇ ਹੈ ਇਲੈਕਟਰੋਨ ਘੜੀ ਦੇ ਤੁਸੀਂ ਕਿੱਥੇ ਵੀ ਹੋ ਤੁਹਾਨੂੰ ਪਤਾ ਚੱਲ ਜਾਂਦਾ ਤੁਹਾਡੀ ਫੋਨ 'ਤੇ ਕਾਲ ਆ ਰਹੀ ਹੈ ਕੋਈ ਮੈਸੇਜ ਆ ਰਿਹਾ ਅਤੇ ਮੈਂ ਜਦੋਂ ਕਿ ਇਸ ਘੜੀ ਨੂੰ ਯੂਜ ਕਰ ਰਹੀ ਆਂ ਮੇਰੇ ਅ ਮੇਰਾ ਜੋ ਪਰਸਨਲ ਮੇਰਾ ਖੁਦ ਦਾ ਇਹਦੇ ਨਾਲ ਐਕਸਪੀਰੀਐਂਸ ਰਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੇਰੀ ਘੜੀ ਬਹੁਤ ਵਧੀਆ ਇਲੈਕਟਰੋਨਿਕ ਘੜੀ ਤੇ ਮੈਂ ਇਸ ਤੋਂ ਬੜਾ ਹੀ ਸੰਤੁਸ਼ਟ ਹਾਂ ਤੇ ਅ ਜੇਕਰ ਜਦੋਂ ਮਤਲਬ ਜਦੋਂ ਦੀ ਮੈਂ ਯੂਜ਼ ਕਰ ਰਹੀ ਹਾਂ ਮੈਨੂੰ ਹੁਣ ਤੱਕ ਇਸ ਤੋਂ ਕੋਈ ਦਿੱਕਤ ਨਹੀਂ ਆਈ ਅਤੇ ਮੈਂ ਤੁਹਾਨੂੰ ਵੀ ਕਹਿਣਾ ਚਾਹੂੰਗੀ ਤੁਸੀਂ ਵੀ ਇੱਕ ਵਾਰੀ ਇਸ ਨੂੰ ਆਡਰ ਕਰਕੇ ਦੇਖੋ ਅਤੇ ਤੁਸੀਂ ਵੀ ਬੜੇ ਖੁਸ਼ ਹੋਓਗੇ ਮੇਰੀ ਤਰ੍ਹਾਂ